ਅਸੀਂ ਪੰਜਾਬੀ ਹਾਂ ਅਤੇ ਪੰਜਾਬ ਦੇ ਰਹਿਣ ਵਾਲੇ ਹਾਂ ਅਤੇ ਪੰਜਾਬੀ ਬੋਲੀ ਸਾਨੂੰ ਜਿਹੜੀ ਪੰਜਾਬੀ ਭਾਸ਼ਾ ਉਹ ਸਾਡੇ ਬਹੁਤ ਪਸੰਦ ਹੈ ਅਤੇ ਜਿਹੜਾ ਸੱਭਿਆਚਾਰ ਆ ਉਹ ਪੰਜਾਬੀ ਸਾਨੂੰ ਪੰਜਾਬੀਆਂ ਨੂੰ ਬਹੁਤ ਠੀਕ ਲੱਗਦਾ ਅਤੇ ਪੰਜਾਬ 'ਚ ਹੀ ਅਸੀਂ ਰਹਿਣ ਵਾਲੇ ਹਾਂ ਅਤੇ ਪੰਜਾਬੀ ਬੋਲੀ ਸਾਨੂੰ ਬਹੁਤ ਸੋਹਣੀ ਲੱਗਦੀ ਹੈ ਅਤੇ ਜਿਹੜੇ ਹੋਰ ਵੀ ਇਹ ਪੰਜਾਬੀ ਬੋਲੀ ਨੂੰ ਸੁਣਦੇ ਆ ਤੇ ਉਹਨਾਂ ਨੂੰ ਵੀ ਬਹੁਤ ਸੋਹਣੀ ਲੱਗਦੀ ਹੋਵੇਗੀ ਅਤੇ ਜਿਹੜੇ ਕੋਈ ਗੀਤ ਆਉਂਦੇ ਆ ਪੰਜਾਬੀ ਸੱਭਿਆਚਾਰ ਦੇ ਜਾਂ ਕੋਈ ਕੁੜੀਆਂ ਦੇ ਵਿਆਹ ਦੇ ਸੁਹਾਗ ਮੁੰਡਿਆਂ ਦੇ ਵਿਆਹ ਦੀਆਂ ਘੋੜੀਆਂ ਬੋਲੀਆਂ ਉਹ ਸਾਰਾ ਕੁਛ ਪੰਜਾਬੀ 'ਚ ਹੈ ਪੰਜਾਬੀ ਭਾਸ਼ਾ ਅਸੀਂ ਬੋਲ ਰਹੇ ਆ ਅਤੇ ਹੋਰ ਬੋਲੀ ਸਾਨੂੰ ਨਹੀਂ ਬੋਲਣੀ ਆਉਂਦੀ ਅਤੇ ਨਾ ਹੀ ਸਾਨੂੰ ਇੰਨੀ ਫਿਟ ਬਹਿੰਦੀ ਹੈ ਅਤੇ ਇਹ ਪੰਜਾਬ ਦੇ ਰਹਿਣ ਵਾਲਿਆਂ ਨੂੰ ਤਾਂ ਪੰਜਾਬੀ ਸੋਂਹਦੀ ਹੈ ਅਤੇ ਪੰਜਾਬ ਦੇ ਜਿਹੜੇ ਗੀਤ ਬੋਲੀਆਂ ਹੈ ਉਹ ਸਾਨੂੰ ਬਹੁਤ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਖੈਰ ਬਹੁਤ ਚੰਗੀਆਂ ਲੱਗਦੀਆਂ ਸਭਿਆਚਾਰ ਹੈ ਜਿਹੜਾ ਵੀ ਵਿਆਹ ਦਾ ਕੋਈ ਗੀਤ ਗਾਈ ਦੇ ਆ ਘੋੜੀਆਂ ਗਾਈ ਦੀਆਂ ਕੁੜੀਆਂ ਦੇ ਵਿਆਹ ਦੇ ਸੁਹਾਗ ਗਾਈ ਦੇ ਹੈ ਨਾ ਅਤੇ ਉਹ ਪੰਜਾਬੀ ਦੇ ਵਿੱਚ ਹੀ ਬਹੁਤ ਸੋਹਣੇ ਅਤੇ ਸਭਿਆ ਘਰ ਦੇ ਜਿਹੜਾ ਹੈਗਾ ਸੱਭਿਆਚਾਰ ਤੇ ਬਹੁਤ ਠੀਕ ਲੱਗਦਾ ਅਤੇ ਬਹੁਤ ਹੀ ਸੁਣਨ ਵਾਲੇ ਨੂੰ ਵੀ ਬਹੁਤ ਵਧੀਆ ਲੱਗਦਾ